ਪੰਜਾਬ ਦੇ ਵਿੱਚ ਕਹਿ ਦੇਈਏ ਜਾਂ ਸਾਡੇ ਪਿੰਡ ਦਾ ਜਿਹੜਾ ਲੋਕ ਨਾਚ ਹੈਗਾ ਉਹ ਹੈਗਾ ਭੰਗੜਾ ਅਤੇ ਸਾਡੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਭੰਗੜਾ ਹੀ ਪਸੰਦ ਕੀਤਾ ਜਾਂਦਾ ਹੈ ਅਤੇ ਲੋਕ ਭੰਗੜਾ ਜਿਹੜਾ ਹੈਗਾ ਨਾ ਵਿਆਹ ਸ਼ਾਦੀਆਂ 'ਤੇ ਜਿੱਦਾਂ ਕੋਈ ਤਿਉਹਾਰ ਆ ਜਾਂਦਾ ਹੈ ਜਾਂ ਕੋਈ ਕਿਸੇ ਘਰ ਕੋਈ ਖੁਸ਼ੀ ਦੀ ਗੱਲ ਹੁੰਦੀ ਕੋਈ ਬੱਚਾ ਜਨਮ ਲੈਂਦਾ ਅਤੇ ਜਾਂ ਫਿਰ ਉਹ ਕੋਈ ਵਧੀਆ ਕੰਮ ਕਰਕੇ ਕੋਈ ਖਿਡਾਰੀ ਜਿੱਤ ਕੇ ਆਉਂਦਾ ਕੋਈ ਮੈਡਲ ਲੈ ਕੇ ਆਉਂਦਾ ਤਾਂ ਫਿਰ ਪੰਜਾਬ ਵਿੱਚ ਭੰਗੜਾ ਪਾਇਆ ਜਾਂਦਾ ਵੁਮੈਨ ਜਿਹੜਾ ਭੰਗੜਾ ਹੈ ਉਹ ਵਿਹਾਹਾਂ 'ਤੇ ਪਾਇਆ ਜਾਂਦਾ ਹੈ ਜਿੱਦਾਂ ਜਾਗੋ 'ਤੇ ਡੀ ਜੇ 'ਤੇ ਜਾਂ ਬਰਾਤ ਵਾਲੇ ਦਿਨ ਉਸ ਦਿਨ ਇਹ ਭੰਗੜਾ ਪਾਇਆ ਜਾਂਦਾ ਹੈ ਅਤੇ ਬਾਕੀ ਪੰਜਾਬੀ ਭੰਗੜਾ ਪਾਉਣ ਲਈ ਹਰ ਟਾਈਮ ਤਿਆਰ ਹੀ ਰਹਿੰਦੇ ਨੇ